ਹਾਂਜੀ ਮੈਂ ਇਹ ਪਤਾ ਕਰਨਾ ਸੀ ਕਿ ਮੇਰੇ ਮੋਬਾਈਲ ਨੰਬਰ 'ਤੇ ਜੁੜਾ ਜਿਹੜਾ ਨੰਬਰ ਚੱਲ ਰਿਹਾ ਜਿਹੜੀ ਸਿਮ 'ਤੇ ਮੇਰਾ ਮੋਬਾਈਲ ਨੰਬਰ ਚੱਲ ਰਿਹਾ ਕਿ ਉਹਦੇ ਵਿੱਚ ਕਿੰਨਾ ਕੁ ਬੈਲੈਂਸ ਹੈ ਕਿਉਂਕਿ ਮੈਨੂੰ ਬੈਲੈਂਸ ਦਾ ਪਤਾ ਨਹੀਂ ਲੱਗ ਰਿਹਾ ਅਤੇ ਮੈਂ ਬੈਲੈਂਸ ਪਤਾ ਕਰਨ ਵਾਸਤੇ ਹੀ ਇਹ ਕੋਲ ਮਿਲਾਈ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੇਰੇ ਖਾਤੇ 'ਚ ਕਿੰਨਾ ਬਕਾਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਖਾਤੇ 'ਚ ਬਕਾਇਆ ਹੈ ਪਰ ਜਦੋਂ ਮੈਂ ਕੱਲ੍ਹ ਫੋਨ ਮਿਲਾਇਆ ਤਾਂ ਉਹਨਾਂ ਨੇ ਉਹਨਾਂ ਨੂੰ ਉੱਥੇ ਕੰਪਿਊਟਰ ਵੱਲੋਂ ਬੋਲਿਆ ਗਿਆ ਕਿ ਤੁਹਾਡੇ ਖਾਤੇ ਵਿੱਚ ਬੈਲੈਂਸ ਥੋੜ੍ਹਾ ਕਮ ਹੈ ਪਰ ਮੈਨੂੰ ਯਾਦ ਹੈ ਕਿ ਮੈਂ ਹੁਣ ਹੀ ਕੁਝ ਦਿਨ ਪਹਿਲਾਂ ਹੀ ਰੀਚਾਰਜ ਕਰਵਾਇਆ ਸੀ ਤਾਂ ਹੁਣ ਇਹ ਕਿਵੇਂ ਦੱਸ ਰਿਹਾ ਕਮ ਬੈਲੈਂਸ ਕਿਵੇਂ ਦੱਸ ਰਹੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹਦਾ ਬੈਲੈਂਸ ਕਿੰਨਾ ਹੈ ਹਾਂਜੀ ਮੇਰਾ ਨੰਬਰ ਮੋਬਾਇਲ ਨੰਬਰ ਇਹ ਹੈ ਜੀ ਨਾਈਨ ਏਟ ਸੈਵਨ ਸਿਕਸ ਫਾਈਵ ਫੋਰ ਥ੍ਰੀ ਵੰਨ ਟੂ ਜੀਰੋ ਮੈਮ ਥੋੜ੍ਹਾ ਜਲਦੀ ਮੈਨੂੰ ਦੱਸ ਦਿਆ ਜੇ ਤਾਂ ਕਿ ਮੈਂ ਮਤਲਬ ਆਪਣਾ ਫਿਰ ਅੱਗੇ ਦੇਖ ਸਕਾਂ ਕਿ ਮੇਰਾ ਬੈਲਿੰਸ ਹੈ ਜਾਂ ਨਹੀਂ ਹੈ ਧੰਨਵਾਦ ਜੀ